ਨਹੀਂ ਮੈਂ ਫਿਲਮੀ ਕੈਮਰੇ ਨਾਲ ਸ਼ੂਟਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਆਪਣੇ ਮੋਬਾਈਲ ਤੇ ਰੀਲਾ ਬਣਾਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਪਤਾ ਹੈ ਡਿਜਿਟਲ ਫੋਟੋਗ੍ਰਾਫੀ 'ਚ ਔਰ ਫਿਲਮੀ ਕੈਮਰੇ 'ਚ ਬਹੁਤ ਫਰਕ ਹੈ ਉਥੇ ਬਹੁਤ ਕਲੀਅਰ ਚੀਜ਼ਾਂ ਨਜ਼ਰ ਆਉਂਦੀਆਂ ਜੇ ਕੋਈ ਮਿਸਟੇਕ ਵੀ ਹੋ ਜਾਂਦੀ ਹੈ ਤਾਂ ਉਹਨੂੰ ਕੱਟ ਕੱਟ ਕਰਕੇ ਦੁਬਾਰਾ ਰਿਪੀਟ ਕੀਤਾ ਜਾਂਦਾ ਹੈ ਪਰ ਮੈਂ ਹਮੇਸ਼ਾ ਆਪਣੇ ਫੋਨ ਦੇ ਨਾਲ ਹੀ ਆਪਣੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਐ ਔਰ ਮੈਨੂੰ ਵਧੀਆ ਵੀ ਲੱਗਦਾ ਹੈ